ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਇੱਕੀ ਮਾਰਚ ਦੋ ਹਜ਼ਾਰ ਵੀਹ ਇੱਕ ਜੂਨ ਉੱਨੀ ਸੌ ਚੁਰਾਸੀ ਛੇ ਜੂਨ ਉੱਨੀ ਸੌ ਚੁਰਾਸੀ